ਹੈਲੋ ਸਰ ਕੀ ਤੁਸੀਂ ਏਅਰਟੈੱਲ ਸਰਵਿਸਿਸ ਤੋਂ ਬੋਲ ਰਹੇ ਓ ਹਾਂਜੀ ਸਰ ਮੈਂ ਤੁਹਾਨੂੰ ਆਪਣੇ ਮਤਲਬ ਇੰਟਰਨੈੱਟ ਸਪੀਡ ਦੇ ਬਾਰੇ ਵਿੱਚ ਦੱਸਣਾ ਚਾਹੁੰਦੀ ਹਾਂ ਸਰ ਮੇਰੀ ਇੰਟਰਨੈੱਟ ਸਪੀਡ ਜੋ ਹੈ ਉਹ ਫਿਫਟੀ ਮਤਲਬ ਪਰਸੈਂਟ ਜੋ ਮੇਰਾ ਡਾਟਾ ਹੈ ਉਹ ਯੂਜ ਹੋ ਚੁੱਕਿਆ ਹੈ ਪਰੰਤੂ ਜੋ ਮੇਰੇ ਇੰਟਰਨੈੱਟ ਸਪੀਡ ਹੈ ਇਹ ਬਹੁਤ ਜ਼ਿਆਦਾ ਮਤਲਬ ਸਲੋਅ ਚੱਲ ਰਹੀ ਹੈ ਮੈਂ ਤੁਹਾਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੀ ਹਾਂ ਤਾਂ ਕਿ ਜੋ ਮੇਰੇ ਇਹ ਜੋ ਮੇਰਾ ਹੱਲ ਹੈ ਜਲਦੀ ਤੋਂ ਜਲਦੀ ਹੋ ਸਕੇ ਕਿਉਂਕੀ ਮੈਨੂੰ ਇਸ ਦੇ ਕਾਰਨ ਬਹੁਤ ਜ਼ਿਆਦਾ ਹੀ ਸਮੱਸਿਆਵਾਂ ਆ ਰਹੀਆਂ ਹਨ ਜਿਸ ਦੇ ਕਰਕੇ ਮੈਂ ਆਪਣਾ ਜੋ ਵੀ ਔਨਲਾਈਨ ਕੰਮ ਹੈ ਨਹੀਂ ਕਰ ਪਾ ਰਹੀ ਹਾਂ ਪਲੀਸ ਸਰ ਮੇਰੀ ਜਿਹੜੀ ਇਹ ਸਮੱਸਿਆ ਏ ਜਲਦ ਤੋਂ ਜਲਦ ਇਹ ਠੀਕ ਕੀਤੀ ਜਾਵੇ ਅਤੇ ਮੇਰਾ ਜਿਹੜਾ ਇੰਟਰਨੈੱਟ ਹੈ ਆਪਣੀ ਪਹਿਲਾਂ ਦੀ ਤਰ੍ਹਾਂ ਜਿਸ ਤਰ੍ਹਾਂ ਇੰਟਰਨੈੱਟ ਦੀ ਸਪੀਡ ਪਹਿਲਾਂ ਸੀ ਉਸੀ ਤਰ੍ਹਾਂ ਇੰਟਰਨੈੱਟ ਦੀ ਜਿਹੜੀ ਸਰਵਿਸਿਸ ਹੈ ਮੈਨੂੰ ਮਿਲੇ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਜਿਹੜੀ ਮੇਰੀ ਇਹ ਸਮੱਸਿਆ ਹੈ ਇਹਨੂੰ ਜਲਦ ਤੋਂ ਜਲਦ ਹੱਲ ਕਰੋ ਤਾਂ ਕਿ ਜੋ ਮੈਂ ਆਪਣਾ ਕੰਮ ਸਹੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਜਲਦੀ ਤੋਂ ਜਲਦੀ ਕਰ ਪਾਵਾਂ ਅਤੇ ਤੁਸੀਂ ਮੇਰੇ ਇਸ ਜਿਹੜਾ ਮੇਰੇ ਸਮੱਸਿਆ ਹੈ ਇਹਦੇ 'ਤੇ ਜਲਦ ਤੋਂ ਜਲਦ ਐਕਸ਼ਨ ਲਓ